ਮੈਂ ਆਪਣੇ ਜਾਨਵਰਾਂ ਦੀ ਦੇਖਭਾਲ ਕਰਦੀ ਹਾਂ ਅਤੇ ਮੈਂ ਮੇਰੇ ਨਾਲ ਦੋ ਬੰਦੇ ਵੀ ਰੱਖੇ ਹੋਏ ਹਨ ਜਿਹਨਾਂ ਦੀ ਮਦਦ ਨਾਲ ਮੈਂ ਉਹਨਾਂ ਦੀ ਪੂਰੀ ਤਰ੍ਹਾਂ ਦੇਖਭਾਲ ਕਰਦੀ ਹਾਂ ਅਤੇ ਇਸ ਦੇ ਨਾਲ ਨਾਲ ਮੈਂ ਉਹਨਾਂ ਦੇ ਹਾਈਜੀਨ ਦਾ ਵੀ ਪੂਰਾ ਖਿਆਲ ਰੱਖਦੀ ਹਾਂ ਉਹਨਾਂ ਨੂੰ ਗਰਮੀਆਂ ਵਿੱਚ ਨਹਾਉਣਾ ਅਤੇ ਸਾਫ਼ ਜਗ੍ਹਾ 'ਤੇ ਉਹਨਾਂ ਨੂੰ ਰੱਖਣਾ ਇਹ ਮੇਰੇ ਲਈ ਬਹੁਤ ਜ਼ਰੂਰੀ ਹੁੰਦਾ ਹੈ ਮੈਂ ਮੇਰੇ ਜਾਨਵਰਾਂ ਦੀ ਦੇਖਭਾਲ ਇੰਝ ਕਰਦੀ ਹਾਂ ਜਿਵੇਂ ਕਿ ਉਹ ਮੇਰੇ ਪਰਿਵਾਰ ਦੇ ਸਦੱਸਿਆ ਹੀ ਹੋਣ